ਭੰਗੜਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਭੰਗੜਾ ਦਰਸਾਉਂਦਾ ਹੈ ਪੰਜਾਬੀਆਂ ਨੂੰ ਅਤੇ ਸਿੱਖਾਂ ਨੂੰ ਅਤੇ ਭੰਗੜਾ ਅਲੱਗ ਅਲੱਗ ਜਿਹਨੂੰ ਆਪਾਂ ਕਹਿ ਦਈਏ ਅਲੱਗ ਅਲੱਗ ਤਿਉਹਾਰਾਂ 'ਤੇ ਕੀਤਾ ਜਾਂਦਾ ਜਿੱਦਾਂ ਕਿਸੇ ਵੀ ਤਿਉਹਾਰ 'ਤੇ ਕੀਤਾ ਜਾਂਦਾ ਕੋਈ ਅਲੱਗ ਕੋਈ ਸੇਲੀਬਰੇਸ਼ਨ ਉੱਥੇ ਕੀਤਾ ਜਾਂਦਾ ਵਿਆਹ ਸ਼ਾਦੀਆਂ 'ਤੇ ਵੀ ਭੰਗੜਾ ਬਹੁਤ ਹੁੰਦਾ ਆ ਅਤੇ ਭੰਗੜਾ ਇੱਕ ਫਿਟਨੇਸ ਫੋਰਮ ਵੀ ਬਹੁਤ ਵਧੀਆ ਭੰਗੜੇ ਦੀ ਕਿ ਭੰਗੜਾ ਕਰਕੇ ਤੁਸੀਂ ਫਿੱਟ ਰਹੂੰਗੇ ਤੁਹਾਡੀ ਬੋਡੀ ਖੁੱਲ੍ਹੀ ਰਹੇਗੀ ਤੁਹਾਡਾ ਮਾਇੰਡ ਫ੍ਰੈਸ਼ ਰਹੇਗਾ ਤੁਸੀਂ ਫਿੱਟ ਰਹੂੰਗੇ ਅਤੇ ਭੰਗੜਾ ਜਿਹਨੂੰ ਆਪਾਂ ਕਹਿ ਲਈਏ ਆਪਣੇ ਯੂਥ ਨੂੰ ਜਿਹੜਾ ਆਪਣਾ ਅੱਜ ਕੱਲ੍ਹ ਦਾ ਜਿਹੜਾ ਬੱਚੇ ਹੈਗੇ ਨੇ ਉਹਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦਾ ਅਤੇ ਜਿੱਦਾਂ ਹੁਣ ਪੰਜਾਬ 'ਚ ਕਈ ਲੋਕ ਬਾਹਰ ਵੀ ਰਹਿੰਦੇ ਨੇ ਅਤੇ ਉੱਥੇ ਵੀ ਭੰਗੜਾ ਬਹੁਤ ਪ੍ਰਚਲਿਤ ਹੈ ਕਿ ਉੱਥੇ ਦਾ ਜਿਹੜਾ ਆਪਣਾ ਯੂਥ ਹੈ ਉਹ ਹਾਲੇ ਵੀ ਆਪਣੇ ਕਲਚਰ ਨੂੰ ਨਹੀਂ ਭੁੱਲਿਆ ਆਪਣੇ ਸੱਭਿਆਚਰ ਨੂੰ ਨਹੀਂ ਭੁੱਲਿਆ ਅਤੇ ਉੱਥੇ ਵੀ ਉਹ ਭੰਗੜਾ ਹਾਲੇ ਵੀ ਕਰਦੇ ਨੇ ਅਤੇ ਦੁਨੀਆ ਭਰ 'ਚ ਭੰਗੜਾ ਬਹੁਤ ਹੀ ਮਸ਼ਹੂਰ ਹੈ ਬਹੁਤ ਹੀ ਕਿਉਂਕਿ ਹਰ ਇੱਕ ਪਾਸੇ ਪੰਜਾਬੀ ਨੇ ਅਤੇ ਉਸ ਕਾਰਨ ਭੰਗੜਾ ਸਾਰੇ ਪਾਸੇ ਹੈ ਅਤੇ ਭੰਗੜੇ ਦੇ ਕਾਰਨ ਜਿੱਦਾਂ ਆਪਾਂ ਕਹਿ ਲਈਏ ਲੋਕਾਂ 'ਚ ਮਿਲਣਾ ਵਾਪਰਨਾ ਵੀ ਬਹੁਤ ਹੁੰਦਾ ਭੰਗੜੇ 'ਚ ਸਾਨੂੰ ਪਤਾ ਲੱਗਦਾ ਹੈ ਕਿ ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ ਇੱਕ ਤਰ੍ਹਾਂ ਦਾ ਭੰਗੜਾ ਬਹੁਤ ਹੀ ਜਿਹਨੂੰ ਕੈਪੇ ਲੋਕ ਨਾਚ ਹੈ ਪੰਜਾਬ ਦਾ ਇੱਥੇ ਦੇ ਜਿਹੜੇ ਬੱਚੇ ਨੇ ਉਹ ਬਹੁਤ ਹੀ ਮਤਲਬ ਵਧੀਆ ਤਰੀਕੇ ਨਾਲ ਭੰਗੜਾ ਕਰਦੇ ਨੇ ਅਤੇ ਇਹ ਦੁਨੀਆ ਭਰ 'ਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਅਤੇ ਧੰਨਵਾਦ